ਮੇਰੇ ਇਲਾਕੇ ਵਿੱਚ ਪ੍ਰਮੁੱਖ ਬਰੈਂਡ ਸੈਮਸੰਗ ਵੀਵੋ ਰਿਲਾਇਸ ਅਤੇ ਆਈਫੋਨ ਨੇ ਅਤੇ ਇਹਨਾਂ ਵਿੱਚੋਂ ਮੇਰੇ ਕੋਲ ਵੀਵੋ ਦਾ ਵਧੀਆ ਬਰੈਂਡ ਫੋਨ ਹੈ ਜੋ ਕਿ ਮੈਨੂੰ ਬਹੁਤ ਸੋਹਣਾ ਅਤੇ ਚੰਗਾ ਲੱਗਦਾ ਹੈ ਇਹ ਫੋਨ ਵਿੱਚ ਬਹੁਤ ਜ਼ਿਆਦਾ ਵਧੀਆ ਫੰਕਸ਼ਨਿੰਗ ਅਤੇ ਅਤੇ ਇੱਕ ਵਧੀਆ ਬ੍ਰਾਂਡ ਦਾ ਕੈਮਰਾ ਹੈ ਇਹ ਕੈਮਰਾ ਬਹੁਤ ਹੀ ਸਾਫ਼ ਫੋਟੋ ਖਿੱਚਦਾ ਹੈ ਅਤੇ ਵਧੀਆ ਫੋਟੋ ਅਪਲੋਡ ਵੀ ਕਰਦਾ ਹੈ ਇਹ ਫੋਨ ਦੀ ਬੈਂਟਰੀ ਬਹੁਤ ਵਧੀਆ ਹੈ ਜੋ ਕਿ ਲੰਬੇ ਸਮੇਂ ਤੱਕ ਚੱਲ ਜਾਂਦੀ ਹੈ